ਹਾਂਜੀ ਮੈਨੂੰ ਡਾਂਸ ਸਿੱਖਣ ਦਾ ਜਿਹੜਾ ਮੌਕਾ ਮਿਲਿਆ ਤਾਂ ਜਿਹੜਾ ਕੀ ਆ ਸਾਡੇ ਨਾ ਇੱਥੇ ਬਰਨਾਲਾ ਸ਼ਹਿਰ ਦੇ ਵਿੱਚ ਅਕੈਡਮੀ ਖੁੱਲ੍ਹੀ ਹੋਈ ਹੈਗੀ ਕਲਚਰ ਅਕੈਡਮੀ ਕਹਿੰਦੇ ਹੈਗੇ ਉਹਨੂੰ ਮੈਂ ਉਹਦੇ ਵਿੱਚ ਕੀ ਹੈਗਾ ਐਡਮਿਸ਼ਨ ਲਈ ਸੀ ਅਤੇ ਮੈ ਜਿਹੜਾ ਕੀ ਆ ਕਿ ਤਿੰਨ ਚਾਰ ਮਹੀਨੇ ਲਾਏ ਸੀਗੇ ਅਤੇ ਮੈਂ ਜਿਹੜਾ ਭੰਗੜਾ ਸਿੱਖਿਆ ਉੱਥੇ ਮੈਨੂੰ ਇੰਨੀ ਵਧੀਆ ਸਟੈਪ ਉਹਦੇ ਜਿਵੇਂ ਖੁੱਲ੍ਹਾ ਭੰਗੜਾ ਬੰਦ ਪੰਜਾਬ ਸੱਚ ਤਾੜੀ ਬੋਲਚਾਲ ਅਤੇ ਫੂੰਮਣੀਆਂ ਇੱਦਾਂ ਦੇ ਮੈਂ ਸਾਰੇ ਸਟੈਪ ਉੱਥੇ ਸਿੱਖੇ ਅਤੇ ਉਹ ਮੈਨੂੰ ਸਿੱਖ ਕੇ ਨਾ ਵੀ ਬਹੁਤ ਵਧੀਆ ਲੱਗਿਆ ਨਾਲੇ ਤਾਂ ਉਹ ਹਲਕੀ ਫੁਲਕੀ ਕਸਰਤ ਜੀ ਹੋ ਜਾਂਦੀ ਹੈਗੀ ਅਤੇ ਬਹੁਤ ਵਧੀਆ ਲੱਗਿਆ ਮੈਨੂੰ ਉਸ ਸਿੱਖ ਕੇ ਅਤੇ ਪ੍ਰਦਰਸ਼ਨ ਤਾਂ ਨਹੀਂ ਮੈਂ ਹੈਗਾ ਬਾਹਲਾ ਕੀਤਾ ਸਟੇਜ ਵਗੈਰਾ 'ਤੇ ਵੀ ਚੱਲ ਐਂ ਵੀ ਆਪ ਦੇ ਆਪਨੂੰ ਅਸੀਂ ਸਿੱਖ ਲਿਆ ਜੀ ਬਸ ਉਹ